ਹਾਂਜੀ ਇਵੇਂ ਐਂ ਹੈਗਾ ਵੀ ਜਿਹੜਾ ਹੈਗਾ ਜਦੋਂ ਭੰਗੜਾ ਕਰਦੇ ਹਾਂ ਅਸੀਂ ਤਾਂ ਸਾਡੇ ਉਹ ਫੇਸ ਇਨ ਇੰਸਟ੍ਰਕਸ਼ਨ ਅਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਬਾਹਾਂ ਦਾ ਜ਼ੋਰ ਲੱਗਦਾ ਲੱਤਾਂ ਦਾ ਜ਼ੋਰ ਲੱਗਦਾ ਹੈ ਧੋਣ ਹਿੱਲਦੀ ਹੈ ਅੱਗੇ ਪਿੱਛੇ ਕਰਦੇ ਹਾਂ ਅਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰੇ ਅੰਗ ਪੈਰਾਂ ਦਾ ਹੋ ਜਾਂਦਾ ਅਤੇ ਉਹ ਹੁੰਦਾ ਵੀ ਕੀ ਨਾਂਅ ਲੈਂਦੇ ਉਹ ਇਹ ਇੱਕ ਤਰ੍ਹਾਂ ਨਾਲ ਸਾਡੀ ਉਹਦੇ ਨਾਲ ਫਿੱਟਨੈੱਸ ਵੀ ਵਧਦੀ ਹੈ ਅਤੇ ਨਾਲੇ ਸਾਡਾ ਭੰਗੜਾ ਸੱਭਿਆਚਾਰਕ ਭੰਗੜਾ ਹੋ ਜਾਂਦਾ ਹੈ ਨਾਲੇ ਸਾਡਾ ਮਨ ਪਰਚਾਵਾ ਹੋ ਜਾਂਦਾ ਹੈ ਅਤੇ ਨਾਲ ਇਹਦੇ ਨਾਲ ਸਾਡੇ ਸਰੀਰ ਦੀ ਫਿੱਟਨੈੱਸ ਵਧਦੀ ਹੈ ਅਤੇ ਇਹ ਇੱਕ ਦੂਜੇ ਤੋਂ ਹੈ ਤਾਂ ਭਿੰਨ ਹੀ ਹੈ ਅਤੇ ਪਰ ਸੇਮ ਸੇਮ ਵੀ ਹੋ ਸਕਦੇ ਕਿਉਂਕਿ ਯੋਗਾ ਕਰਦੇ ਹਾਂ ਸਾਡੀ ਇਹ ਐਕਸਰਸਾਈਜ ਵੀ ਹੋ ਜਾਂਦੀ ਹੈ ਅਤੇ ਨਾਲ ਭੰਗੜਾ ਹੋ ਜਾਂਦਾ ਸਾਡਾ ਸੱਭਿਆਚਾਰ ਹੋ ਜਾਂਦਾ ਨਾਲ ਨਾਲ ਨਾਲ ਸਾਡਾ ਸਰੀਰ ਫਿੱਟ ਰਹਿੰਦਾ ਹੈ ਇਹਦੇ ਵਿੱਚ ਅਤੇ ਇਸ ਤਰ੍ਹਾਂ ਇਹ ਦੋਵੇਂ ਚੀਜ਼ਾਂ ਇੱਕ ਦੂਜੇ ਤੋਂ ਹੈ ਤਾਂ ਭਿੰਨ ਹੈ ਪਰ ਅਸਰ ਸਾਡਾ ਇੱਕੋਂ ਜਿਹਾ ਹੀ ਇਨ੍ਹਾਂ ਦੇ ਹਿਸਾਬ ਦੇ ਨਾਲ ਹੋ ਜਾਂਦਾ ਹੈ ਅਤੇ ਧੰਨਵਾਦ